ਅੱਜ ਕੱਲ੍ਹ ਸਭ ਤੋਂ ਵੱਧ ਜਿਹੜੀਆਂ ਐਪਸ ਨੇ ਉਹ ਵਰਤੀਆਂ ਜਾਣ ਵਾਲੀਆਂ ਐਪਸ ਨੇ ਫੇਸਬੁੱਕ ਫੇਸਬੁੱਕ ਇੰਸਟਾਗਰਾਮ ਸਨੈਪਚੈਟ ਯੂਟਿਊਬ ਆਦਿ ਹਨ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਹੋ ਰਹੀ ਆ ਅਤੇ ਇਹਨਾਂ ਇਹਨਾਂ ਐਪਸ ਦੇ ਜਿੱਥੇ ਸਾਨੂੰ ਕੁਛ ਫਾਇਦੇ ਨੇ ਅਤੇ ਉੱਥੇ ਕੁਛ ਨੁਕਸਾਨ ਵੀ ਨੇ ਫਾਇਦੇ ਸਾਨੂੰ ਇਹ ਆ ਕਿ ਅਸੀਂ ਆਪਣੇ ਜਿਹੜੇ ਸਾਰੇ ਕੰਮ ਨੇ ਆਫ਼ਿਸ ਵਰਕ ਵਗੈਰਾ ਉਹ ਅਸੀਂ ਆਪਣਾ ਘਰ ਬੈਠੇ ਹੀ ਕਰ ਸਕਦੇ ਹਾਂ ਜਿਵੇਂ ਜੀਮੇਲ 'ਤੇ ਸਾਨੂੰ ਪਤਾ ਚਲ ਜਾਂਦਾ ਹੈ ਕਿ ਸਾਨੂੰ ਕਿਥੋਂ ਕ ਕਿਹੜਾ ਕੰਮ ਸਾਡੇ ਆਫ਼ਿਸ ਤੋਂ ਆ ਰਿਹਾ ਹੈ ਅਤੇ ਯੂਟਿਊਬ ਤੋਂ ਅਸੀਂ ਆਪਣੇ ਕੰਮ ਦੇ ਬਾਰੇ ਵੱਧ ਤੋ ਵੱਧ ਸਰਚ ਕਰਕੇ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਰੁਮਾਂਚਕ ਬਣਾ ਸਕਦੇ ਹਾਂ ਪਰ ਅੱਜ ਦੇ ਟਾਇਮ ਦੇ ਵਿੱਚ ਜਿਹੜੇ ਨੁਕਸਾਨ ਨੇ ਇਸ ਇ ਇਹਨਾਂ ਐਪਸ ਦੇ ਵਿੱਚ ਉਹ ਬੱਚਿਆ ਨੂੰ ਲੈ ਕੇ ਬਹੁਤ ਜ਼ਿਆਦਾ ਨੁਕਸਾਨਦਾਇਕ ਨੇ ਕਿ ਉਹ ਫੋਨ ਦਾ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਨੇ